ਲੋਕਡਾਊਨ ਵਿੱਚ ਫ੍ਰੀ ਸੀਗੇ ਘਰ ਸੀ ਅਤੇ ਘਰ ਰਹਿ ਕੇ ਬੰਦੇ ਦਾ ਦਿਲ ਕਰਦਾ ਵੀ ਆਹ ਕਰ ਲਈਏ ਆਹ ਕਰ ਲਈਏ ਆਹ ਖਾਹ ਲਈਏ ਚਟਪਟਾ ਬਹੁਤ ਕੁਛ ਖਾਣ ਨੂੰ ਜੀ ਕਰਦਾ ਪਰ ਲੋਕਡਾਊਨ ਦਾ ਸਮਾਂ ਐਸਾ ਸੀ ਕੀ ਤੁਸੀਂ ਕਿਸੇ ਸ਼ੋਪ 'ਤੇ ਨਹੀਂ ਜਾ ਸਕਦੇ ਕਿਤੋਂ ਲਿਆ ਨਹੀਂ ਸਕਦੇ ਕੁਛ ਨਹੀਂ ਕਰ ਸਕਦੇ ਇਸੇ ਇਸ ਲਈ ਲੋਕਡਾਊਨ ਦੇ ਵਿੱਚ ਮੈਂ ਆਪ ਕੂਕਿੰਗ ਕੀਤੀ ਅਤੇ ਵੈਸੇ ਵੀ ਮੈਨੇ ਕੂਕਿੰਗ ਦਾ ਬੜਾ ਸ਼ੌਂਕ ਹੈ ਮੈਂ ਟਿੱਕੀ ਬਣਾਈ ਦਹੀ ਭੱਲੇ ਬਣਾਏ ਅਤੇ ਪਾਣੀ ਪੂਰੀ ਬਣਾਈ ਕਿਉਂਕਿ ਮੈਨੂੰ ਚਾਟ ਪਾਪੜੀ ਵਗੈਰਾ ਬਹੁਤ ਪਸੰਦ ਆ ਚਾਟ ਖਾਣਾ ਮੈਨੂੰ ਬਹੁਤ ਸ਼ੌਂਕ ਹੈ ਇਹ ਚੀਜ਼ਾਂ ਮੇਰੀਆਂ ਫੇਵਰੇਟ ਨੇ ਦਹੀਂ ਭੱਲੇ ਇਜ਼ਲੀ ਬਣ ਜਾਂਦੇ ਨੇ ਦਾਲ ਵਗੈਰਾ ਨਾਲ ਦਾਲ ਭਿਓਂ ਕੇ ਪੀਸ ਕੇ ਉਹ ਕਰਕੇ ਅਤੇ ਇਹ ਚੀਜ਼ਾਂ ਮੋਸਟਲੀ ਜੇ ਟਿ ਟਿੱਕੀ ਬਣਾ ਰਹੇ ਹੋ ਤੁਸੀ ਤਾਂ ਪਾਨੀ ਪੂਰੀ ਲਈ ਪੂਰੀਆਂ ਬਣਾ ਰਹੇ ਹੋ ਤੋ ਇਸ ਚੀਜ਼ਾਂ ਘਰੇ ਅਵੇਲੇਬਲ ਹੁੰਦੀਆਂ ਸੀ ਆਰਾਮ ਨਾਲ ਬਣਾਈਆਂ ਖਾਈਆਂ ਬਹੁਤ ਮਜ਼ਾ ਆਇਆ